ਇੱਕ ਵਾਰ ਦੀ ਗੱਲ ਹੈ ਮੈਂ ਆਈਲਸ ਟ੍ਰੇਨਿੰਗ ਕਰਵਾ ਰਿਹਾ ਸੀ ਅਤੇ ਉੱਥੇ ਮੇਰੇ ਇੱਕ ਸਟਾਫ਼ ਮੈਂਬਰ ਸੀ ਜਿਸ ਦਾ ਨਾਮ ਇੱਕ ਕਪਿਲ ਸੀ ਅਤੇ ਉਸਦੀ ਮੇਰੇ ਨਾਲ ਬਹੁਤ ਘੱਟ ਬਣਦੀ ਸੀ ਮੈਂ ਉਸ ਨੂੰ ਜ਼ਿਆਦਾਤਰ ਇਗਨੋਰ ਕਰਦਾ ਸੀ ਬੁਲਾਉਣ ਲਈ ਨਹੀਂ ਜ਼ਿਆਦਾ ਕਰਦਾ ਸੀ ਪਰ ਕੁਝ ਸਮੇਂ ਬਾਅਦ ਸਾਡੇ ਵਿੱਚ ਅੱਛੀ ਦੋਸਤੀ ਹੋਈ ਪਰ ਦੋ ਮਹੀਨੇ ਬਾਅਦ ਸਾਡੇ 'ਚ ਇੱਕ ਫਿਰ ਝਗੜਾ ਹੋ ਗਿਆ ਪਰ ਉਸ ਸਥਿਤੀ ਨੂੰ ਸੁਲਝਾਉਣ ਲਈ ਮੈਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਿਵੇਂ ਕਿ ਮੈਂ ਉਹਨੂੰ ਅੱਛੇ ਪ੍ਰੇਮ ਨਾਲ ਬੁਲਾਉਣਾ ਉਹ ਨਾਲ ਸਹੀ ਤਰੀਕੇ ਨਾਲ ਗੱਲਬਾਤ ਕਰਨਾ ਅਤੇ ਬਾਹਰ ਘੁੰਮਣ ਫਿਰਨ ਜਾਣਾ ਪਰ ਉਸ ਸਥਿਤੀ ਨੂੰ ਸੁਲਝਾਉਣ ਲਈ ਮੈਂ ਬੇਹੱਦ ਕੋਸ਼ਿਸ਼ ਕੀਤੀ ਪਰ ਅਫਸੋਸ ਉਸ ਸਥਿਤੀ ਨੂੰ ਮੈਂ ਸੁਲਝਾ ਨਹੀਂ ਸਕਿਆ